ਮੈਂ ਆਪਣੇ ਸਕੂਲ ਦੇ ਸਮੇਂ ਵਿੱਚ ਸ਼ੇਡਿੰਗ ਸਿੱਖੀ ਸੀ ਅਤੇ ਸਕੈਚਿੰਗ ਸਿੱਖੀ ਸੀ ਪੋਸਟਰ ਬਣਾਉਣ ਦਾ ਸਲੀਕਾ ਸਿੱਖਿਆ ਸੀ ਅਤੇ ਹੋਰ ਵੀ ਕਲਾ ਕ੍ਰਿਤੀਆਂ ਮੈਂ ਸਿੱਖੀ ਸੀ ਅਤੇ ਉਸਦੇ ਵਿੱਚ ਇੱਕ ਕਲਾ ਕ੍ਰਿਤੀ ਹੈ ਮੇਰੀ ਸ਼ੇਡਿੰਗ ਜੋ ਕਿ ਮੈਂ ਇੱਕ ਕੋਈ ਵੀ ਚਿੱਤਰਕਾਰੀ ਕਰਦੀ ਹਾਂ ਉਸ ਦੇ ਵਿੱਚ ਜਾਨ ਡਾਲਦੀ ਹਾਂ